ਕੁਝ ਸਾਲ ਪਹਿਲਾਂ ਦੇ ਪੁਰਾਣੇ ਮੋਬਾਈਲ ਅਤੇ ਮੌਜੂਦਾ ਸਮਾਰਟਫੋਨ ਵਿੱਚ ਅੰਤਰ ਬਹੁਤ ਨੇ ਜੇ ਅਸੀਂ ਪਹਿਲਾਂ ਦੇ ਮੋਬਾਈਲ ਦੇਖਦੇ ਹਾਂ ਤਾਂ ਪਹਿਲਾਂ ਤਾਂ ਲੋਕਾਂ ਦੇ ਘਰਾਂ 'ਚ ਲੈਂਡਲਾਈਨ ਹੁੰਦੇ ਸੀ ਅਤੇ ਉਹ ਇੱਕੋ ਜਗ੍ਹਾ 'ਤੇ ਹੁੰਦੇ ਸੀ ਕਿਉਂਕਿ ਉਹਨਾਂ 'ਚ ਤਾਰ ਪੈਂਦੀ ਸੀ ਉਹਨਾਂ ਨੂੰ ਆਪਾਂ ਆਪਣੀ ਜੇਬ 'ਚ ਪਾ ਕੇ ਕਿਤੇ ਲੈ ਕੇ ਨਹੀਂ ਸੀ ਜਾ ਸਕਦੇ ਉਨ੍ਹਾਂ ਦਾ ਬਿਲ ਵੀ ਜ਼ਿਆਦਾ ਆਉਂਦਾ ਸੀ ਤਕਰੀਬਨ ਚਾਰ ਪੰਜ ਸੌ ਮਹੀਨੇ ਦਾ ਆ ਹੀ ਜਾਂਦਾ ਸੀ ਪਰ ਜਿਵੇਂ ਜਿਵੇਂ ਸਮਾਂ ਅੱਗੇ ਵਧਿਆ ਬਟਨਾਂ ਵਾਲੇ ਫੋਨ ਆ ਗਏ ਅਤੇ ਬਟਨਾਂ ਵਾਲਾ ਫੋਨ ਦਾ ਸਭ ਤੋਂ ਸੌਖਾ ਕੰਮ ਸੀ ਕਿ ਉਹਨੂੰ ਜੇਬ 'ਚ ਪਾ ਕੇ ਜਿੱਥੇ ਮਰਜ਼ੀ ਲੈ ਜਾਓ ਅਤੇ ਹਰ ਲੋਕ ਹਰ ਕਿਸੇ ਦੀ ਜੇਬ 'ਚ ਉਹ ਫੋਨ ਆ ਗਿਆ ਪਰ ਰੀਚਾਰਜ ਉਦੋਂ ਵੀ ਮਹਿੰਗਾ ਹੀ ਹੁੰਦਾ ਸੀ ਉਦੋਂ ਵੀ ਹਫ਼ਤੇ ਦੇ ਸੌ ਰੁਪਏ ਲੱਗ ਹੀ ਜਾਂਦੇ ਸੀਗੇ ਫਿਰ ਜਿਵੇਂ ਜਿਵੇਂ ਸਮਾਂ ਅੱਗੇ ਵਧਿਆ ਲੋਕਾਂ ਨੇ ਬਟਨ ਵਾਲੇ ਫੋਨ ਤੋਂ ਸਮਾਰਟ ਫੋਨ 'ਤੇ ਆ ਗਏ ਅੱਜ ਕੱਲ੍ਹ ਤਾਂ ਬਹੁਤ ਹੀ ਜ਼ਿਆਦਾ ਸਮਾਰਟ ਫੋਨ ਹੋ ਗਏ ਤਾਂ ਉਹਨਾਂ ਦਾ ਫਾਇਦਾ ਇਹ ਹੈ ਕਿ ਹੁਣ ਜੇ ਕੋਈ ਆਪਣਾ ਯਾਰ ਦੋਸਤ ਦੂਰ ਦੁਰਾਡੇ ਬੈਠਾ ਅਸੀਂ ਉਹਨੂੰ ਜਦੋਂ ਮਰਜ਼ੀ ਫੋਨ ਕਰ ਸਕਦੇ ਹਾਂ ਆਪਣੀਆਂ ਤਸਵੀਰਾਂ ਭੇਜ ਸਕਦੇ ਹਾਂ ਉਹਨਾਂ ਦੀਆਂ ਤਸਵੀਰਾਂ ਉਹਨਾਂ ਤੋਂ ਮੰਗਵਾ ਸਕਦੇ ਹਾਂ ਜਿਹਦੇ ਨਾਲ ਜਦੋਂ ਮਰਜ਼ੀ ਗੱਲ ਕਰ ਸਕਦੇ ਹਾਂ ਆਪਾਂ ਨਵੇਂ ਸਪਾਰਟ ਫੋਨਾਂ 'ਚ ਫੇਸਬੁੱਕ ਯੂਟਿਊਬ ਇਹ ਸਭ ਵੀ ਦੇਖ ਸਕਦੇ ਹਾਂ ਹੁਣ ਜਦੋਂ ਮਰਜ਼ੀ ਆਪਾਂ ਆਪਣੇ ਫੋਨ 'ਚ ਗੂਗਲ ਦੇ ਉੱਤੇ ਕੁਛ ਵੀ ਸਰਚ ਕਰ ਲਾਂਗੇ ਜੇ ਸਾਨੂੰ ਕਿਸੇ ਚੀਜ਼ ਦੀ ਲੋੜ ਹੋਊਗੀ ਪਰ ਇਹ ਪਹਿਲਾਂ ਲੈਂਡਲਾਈਨ ਫੋਨਾਂ 'ਚ ਕਰ ਨਹੀਂ ਸੀ ਸਕਦੇ ਨਾ ਆਪਾਂ ਬਟਨਾਂ ਵਾਲੇ ਫੋਨਾਂ 'ਚ ਕਰ ਸਕਦੇ ਸੀ ਤਾਂ ਨਵੇਂ ਮ ਸਮਾਰਟ ਫੋਨ ਦੇ ਫਾਇਦੇ ਬਹੁਤ ਨੇ ਅਤੇ ਸਮੇਂ ਦੇ ਨਾਲ ਨਾਲ ਨੈਟਵਰਕ ਕਨੈਕਸ਼ਨ ਵੀ ਬੜੇ ਇਮਪਰੂਵ ਹੋ ਗਏ ਪਹਿਲਾਂ ਜਦੋਂ ਲੈਂਡਲਾਈਨ ਹੁੰਦਾ ਸੀ ਤਾਂ ਆਵਾਜ਼ ਬਹੁਤ ਕੱਟਦੀ ਹੁੰਦੀ ਸੀ ਪਰ ਜਿਹੜੇ ਅੱਜ ਕੱਲ੍ਹ ਦੇ ਨਵੇਂ ਸਮਾਰਟ ਫੋਨ ਨੇ ਕਿਉਂਕਿ ਹਰ ਜਗ੍ਹਾ 'ਤੇ ਤਾਂ ਖੰਭੇ ਲੱਗ ਗਏ ਨੇ ਤਾਂ ਉਹਦੇ ਕਰਕੇ ਨੈਟਵਰਕ ਦੀ ਵੀ ਕੋਈ ਬਹੁਤੀ ਦਿੱਕਤ ਨਹੀਂ ਹੁੰਦੀ ਜਦੋਂ ਮਰਜ਼ੀ ਫੋਨ ਲਾ ਲਉ ਆਵਾਜ਼ ਬਿਲਕੁਲ ਠੀਕ ਹੀ ਆਉਂਦੀ ਹੈ ਅਤੇ ਜੇ ਆਪਾਂ ਰੀਚਾਰਜ ਦੀ ਗੱਲ ਕਰੀਏ ਤਾਂ ਪਹਿਲਾਂ ਨੈੱਟ ਪੈਕ ਵੀ ਮਹਿੰਗੇ ਸੀਗੇ ਕਦੇ ਦਸ ਪੰਦਰਾਂ ਦਿਨ ਦੇ ਸੌ ਕੁ ਰੁਪਿਆ ਲੱਗਦਾ ਹੁੰਦਾ ਸੀ ਪਰ ਹੁਣ ਨਵੀਂ ਕੰਪਨੀਆਂ ਆ ਗਈਆਂ ਅਤੇ ਸਮਾਰਟ ਫੋਨ ਨਾਲ ਹੀ ਨੈੱਟ ਪੈਕ ਵੀ ਸਸਤੇ ਹੋ ਗਏ ਨੇ ਤੀਹ ਦਿਨ ਦਾ ਰੀਚਾਰਜ ਦੋ ਸੌ ਰੁਪਏ 'ਚ ਹੋ ਜਾਂਦਾ ਹੈ ਤੇਅ ਜਿਹਦੇ ਨਾਲ ਜਿੰਨੀਆਂ ਮਰਜ਼ੀ ਗੱਲਾਂ ਮਾਰੀ ਜਾਓ ਚਾਹੇ ਆਪਣੇ ਦੇਸ਼ 'ਚ ਕਿਸੇ ਨੂੰ ਫੋਨ ਲਾ ਲਉ ਚਾਹੇ ਬਾਹਰਲੇ ਮੁਲਕ ਕਿਸੇ ਨੂੰ ਫੋਨ ਲਾ ਲਉ ਚਾਹੇ ਯੂਟੀਊਬ 'ਤੇ ਸਾਰਾ ਦਿਨ ਕੁਝ ਦੇਖੀ ਜਾਓ ਚਾਹੇ ਗੂ ਕੁਛ ਗੂਗਲ ਕਰ ਲਉ ਤਾਂ ਜਿਹੜੇ ਸਮਾਰਟ ਫੋਨ ਨੇ ਉਹਨਾਂ ਨੇ ਬਹੁਤ ਇੰਪਰੂਵਮੈਂਟ ਕੀਤੀ ਹੈ ਅਤੇ ਫਾਇਦੇ ਬਹੁਤ ਜ਼ਿਆਦਾ ਨੇ ਪਰ ਜਿੱਥੇ ਹਰ ਚੀਜ਼ ਦੇ ਫਾਇਦੇ ਹੁੰਦੇ ਨੇ ਨੁਕਸਾਨ ਵੀ ਹੁੰਦੇ ਹੀ ਨੇ ਜਿਹੜੀਆਂ ਇਹਦੀਆਂ ਕਿਰਨਾਂ ਨੇ ਉਹ ਉਹਦੇ ਕਰਕੇ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਖ਼ਰਾਬ ਵੀ ਹੁੰਦੀਆਂ ਨੇ ਐਨਕਾਂ ਲੱਗੀਆਂ ਹੋਈਆਂ ਨੇ ਸਾਰਿਆਂ ਦੇ ਪਰ ਜ਼ਿਆਦਾਤਰ ਦੇਖਿਆ ਜਾਵੇ ਤਾਂ ਇਹਦੇ ਫਾਇਦੇ ਹੀ ਨੇ